ਖੇਡਾਂ ਲੋਕਾਂ ਨੂੰ ਸਰੀਰਕ ਅਤੇ ਮਾਨਸਿਕ ਰੂਪ ਵਿੱਚ ਤੰਦਰੁਸਤ ਰੱਖਣ ਵਿੱਚ ਬਹੁਤ ਵੱਡਾ ਯੋਗਦਾਨ ਪਾਉਂਦੀਆਂ ਹਨ ਕਿਸੇ ਵੀ ਖੇਡ ਵਿੱਚ ਭਾਗ ਲੈਣ ਨਾਲ ਸਾਡੇ ਪੂਰੇ ਸਰੀਰ ਦੀ ਵਰਜਿਸ਼ ਹੋ ਜਾਂਦੀ ਹੈ ਸਰੀਰ ਵਿੱਚੋਂ ਗੰਦਾ ਪਸੀਨਾ ਬਾਹਰ ਨਿਕਲਦਾ ਹੈ ਸਾਰੇ ਸਰੀਰ ਵਿੱਚ ਖੂਨ ਦਾ ਪ੍ਰਵਾਹ ਠੀਕ ਹੁੰਦਾ ਹੈ ਜਿਸ ਕਾਰਨ ਕੋਈ ਵੀ ਕਿਸਮ ਦੀਆਂ ਬਿਮਾਰੀਆਂ ਤੋਂ ਬਚ ਬਚਾਅ ਹੁੰਦਾ ਹੈ ਇਸ ਤਰ੍ਹਾਂ ਖੇਡਾਂ ਮਨੁੱਖੀ ਸਰੀਰ ਨੂੰ ਰਿਸ਼ਟ ਪੁਸ਼ਟ ਰੱਖਦੀਆਂ ਹਨ ਜੇਕਰ ਗੱਲ ਕਰੀਏ ਅਜ ਅ ਅੱਜ ਦੇ ਸਮੇਂ ਦੀ ਤਾਂ ਮਾਨਸਿਕ ਤੌਰ 'ਤੇ ਤਾਂ ਆਧੁਨਿਕ ਸਮੇਂ ਦੀ ਭੱਜ ਦੌੜ ਭਰੀ ਜ਼ਿੰਦਗੀ ਵਿੱਚ ਕੰਪਿਊਟਰ ਮੋਬਾਈਲ ਆਦਿ ਦੀ ਵਰਤੋਂ ਕੋਈ ਤੋਂ ਕੁਝ ਸਮਾਂ ਬਰੇਕ ਲੈ ਕੇ ਖੇਡਾਂ ਵਿੱਚ ਭਾਗ ਲੈਣ ਨਾਲ ਮਨੁੱਖ ਦਿਮਾਗੀ ਤੌਰ 'ਤੇ ਤਰੋ ਤਾਜ਼ਾ ਮਹਿਸੂਸ ਕਰਦਾ ਹੈ ਜਿਸ ਨਾਲ ਮਨੁੱਖ ਦੇ ਸ ਹਰੇਕ ਸਰੀਰ ਤਣਾਅ ਮੁਕਤ ਕਰਦਾ ਹੈ ਜਿਸ ਨਾਲ ਮਨੁੱਖ ਦੀ ਹਰੇਕ ਸਰੀਰ ਦੇ ਅੰਗ ਦੀ ਵਰਜਿਸ਼ ਹੋ ਜਾਂਦੀ ਹੈ ਅਤੇ ਉਹ ਮਨੁੱਖ ਦਾ ਹਰੇਕ ਸਰੀਰ ਦਾ ਅੰਗ ਐਕਟਿਵ ਹੋ ਜਾਂਦਾ ਹੈ ਡਿਪਰੈਸ਼ਨ ਤੋਂ ਦੂਰ ਵੀ ਰਹਿੰਦਾ ਹੈ ਇਸ ਨਾਲ ਲੋਕ ਖੇਡਾਂ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਵਿੱਚ ਯੋਗਦਾਨ ਪਾਉਂਦੀਆਂ ਹਨ